ਜਦੋਂ ਵੀ ਆਪਾਂ ਕਿਸੇ ਖੁੱਲ੍ਹੇ ਪਾਣੀ ਵਿੱਚ ਤੈਰਨਾ ਜਾਂ ਕੁੱਦਣਾ ਹੈ ਤਾਂ ਉਦੋਂ ਸਾਨੂੰ ਵੀ ਹ ਜਾਂ ਹੱਥਾਂ ਅਤੇ ਪੈਰਾਂ 'ਤੇ ਕੋਈ ਚਿਕਨਾਹਟ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਨਾਅ ਤੈਰਨ ਵਾਸਤੇ ਸਾਨੂੰ ਪੂਰਾ ਆਪਣਾ ਅਲਾਰਟ ਹੋ ਕੇ ਤੈਰਨਾ ਚਾਹੀਦਾ ਤਾਂਕਿ ਕੋਈ ਚੋਟ ਵਗੈਰਾ ਨਾ ਲੱਗ ਸਕੇ ਤਾਂ ਇਸ ਵਿੱਚ ਸਾਡੇ ਕੱਪੜੇ ਵੀ ਇੱਦਾਂ ਦੇ ਹੋਣੇ ਚਾਹੀਦੇ ਹਨ ਕਿ ਕੋਈ ਫਿਸਲਣ ਵਾਲੀ ਚੀਜ਼ ਨਾ ਸਾਡੇ ਲੱਗੇ ਅਤੇ ਔਰ ਜ਼ਿਆਦਾ ਪਾਣੀ ਦਾ ਵਹਾਅ ਤੇਜ਼ ਨਹੀਂ ਹੋ ਨਾ ਹੋਣਾ ਚਾਹੀ ਹੋਣਾ ਨਹੀਂ ਚਾਹੀਦਾ ਅਤੇ ਬਈ ਜਿਸ ਕਰਕੇ ਅਸੀਂ ਸੇਫ਼ ਨਾ ਹੋ ਸਕੀਏ ਅਤੇ ਹਮੇਸ਼ਾਂ ਸਾਡੇ ਪੈ ਤੈਰਨ ਵੇਲੇ ਪੈਰ ਨੰਗੇ ਹੋਣੇ ਚਾਹੀਦੇ ਹਨ ਪੈਰਾਂ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਪਾਈ ਹੋਣੀ ਚਾਹੀਦੀ ਅਤੇ ਹੱਥਾਂ ਵਿੱਚ ਕੁਛ ਗਲਬਸ ਵਗੈਰਾ ਨਹੀਂ ਹੋਣੇ ਚਾਹੀਦੇ